ਅਸੀਂ ਸਾਰਿਆਂ ਨਾਲ਼ ਖਾਣਾ ਖਾਣ ਦਾ ਬਹੁਤ ਆਨੰਦ ਲੈਂਦੇ ਹਾਂ ਅਤੇ ਇਥੇ ਬਹੁਤ ਸਾਰੇ ਮੌਕੇ ਆਉਂਦੇ ਆ ਜਿਵੇਂ ਕਿਸੇ ਦਾ ਵਿਆਹ ਬਰਡੇ ਐਨੀਵਰਸਰੀ ਲੋਕੀਂ ਆਪਣੇ ਆਂਢ ਗਵਾਂਢ ਦੇ ਰਿਸ਼ਤੇਦਾਰਾਂ ਨੂੰ ਸੱਦ ਕੇ ਆਪਣੀ ਖੁਸ਼ੀ ਸਾਂਝੀ ਕਰਦੇ ਆ ਉਹਨਾਂ ਨਾਲ਼ ਅਤੇ ਲੋਕਾਂ ਨੂੰ ਡਿਨਰ ਜਾਂ ਲੰਚ 'ਤੇ ਬੁਲਾ ਕੇ ਆਪਣੀ ਖੁਸ਼ੀ ਨੂੰ ਸਾਂਝੀ ਕਰਦੇ ਆ ਅਤੇ ਬਹੁਤ ਸਾਰੇ ਜਿਹੜੇ ਜਦੋਂ ਕਿਸੇ ਨੂੰ ਔਫਿਸ 'ਚ ਪ੍ਰਮੋਸ਼ਨ ਮਿਲਦੀ ਹੈ ਤਾਂ ਉਹ ਆਪਣੇ ਆਪਣੇ ਨਾਲ਼ ਵਾਲ਼ੇ ਔਫਿਸ ਮੈਂਬਰਜ਼ ਨੂੰ ਬੁਲਾ ਕੇ ਉਹਨਾਂ ਨੂੰ ਘਰ ਬੁਲਾ ਕੇ ਦਾਵਤ ਦਿੰਦੇ ਆ ਜਾਂ ਕੋਈ ਵੀ ਡਿਨਰ 'ਤੇ ਸੱਦਦੇ ਆ ਜਾਂ ਆਪਣੀ ਕਿਸੇ ਵੀ ਤਰ੍ਹਾਂ ਆਪਣੀ ਖੁਸ਼ੀ ਪ੍ਰਗਟ ਕਰਦੇ ਆ ਕਈ ਲੰਚ ਜਾਂ ਡਿਨਰ ਦੇ ਥਰੂ ਅਤੇ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਘਰਾਂ ਵਿੱਚ ਜਦੋਂ ਧਾਰਮਿਕ ਪ੍ਰੋਗਰਾਮ ਹੁੰਦੇ ਤਾਂ ਉਦੋਂ ਲੋਕੀਂ ਜਦੋਂ ਇਕੱਠੇ ਹੁੰਦੇ ਆ ਅਤੇ ਜਦੋਂ ਇਕੱਠੇ ਬੈਠ ਕੇ ਜਦੋਂ ਖਾਣਾ ਖਾਂਦੇ ਉਦੋਂ ਅਲੱਗੇ ਸਵਾਦ ਆਉਂਦਾ ਏ ਜਦੋਂ ਕੋਈ ਇਕੱਠੇ ਬੈਠ ਕੇ ਭਾਈਚਾਰੇ 'ਚ ਜਦੋਂ ਖਾਣਾ ਖਾਂਦਾ ਅਤੇ ਉਹਦਾ ਨਾਲ ਪਿਆਰ ਵੱਧਦਾ ਜਦੋਂ ਤੀਕ ਦੂਜੇ ਦੀ ਇੱਕ ਦੂਜੇ ਦੀ ਖੁਸ਼ੀ 'ਚ ਜਦੋਂ ਕੋਈ ਖੁਸ਼ੀ 'ਚ ਸ਼ਾਮਲ ਹੁੰਦਾ ਤਾਂ ਅਲੱਗੇ ਹੀ ਖੁਸ਼ੀ ਹੁੰਦੀ ਦੂਏ ਬੰਦੇ ਨੂੰ ਅਤੇ ਲੱ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਜਦੋਂ ਜਿਹਦਾ ਲੋਕੀਂ ਅਨੁਭਵ ਕਰਦੇ ਆ ਅਤੇ ਲੰਚ ਜਾਂ ਡਿਨਰ 'ਤੇ ਬੁਲਾਉਂਦੇ ਆ ਕਿਸੇ ਆਪਣੀ ਖੁਸ਼ੀ ਪ੍ਰਗਟ ਕਰਨ ਲਈ ਅਤੇ ਲਾਸਟ ਟਾਈਮ ਜਦੋਂ ਮੈਂ ਮੇਰੇ ਬਰਡੇ 'ਤੇ ਮੈਂ ਆਪਣੇ ਗੁਆਂਢੀ ਅਤੇ ਰਿਸ਼ਤੇਦਾਰਾਂ ਨੂੰ ਡਿਨਰ 'ਤੇ ਬੁਲਾਇਆ ਅਤੇ ਸਾਰਿਆਂ ਨੇ ਸਾਰੇ ਮੇਰੀ ਖੁਸ਼ੀ ਵਿੱਚ ਸ਼ਾਮਿਲ ਹੋਏ ਸਾਰਿਆਂ ਨੂੰ ਅਤੇ ਲੋਕੀਂ ਡਿਨਰ 'ਤੇ ਡਿਨਰ 'ਤੇ ਸੱਦਾ ਦੇ ਕੇ ਭਿੰਨ ਭਿੰਨ ਪ੍ਰਕਾਰ ਦੀਆਂ ਭਿੰਨ ਭਿੰਨ ਪ੍ਰਕਾਰ ਦੀਆਂ ਡਿਸ਼ੀਜ਼ ਬਣਾਉਂਦੇ ਆ ਉਨ੍ਹਾਂ ਲਈ ਉਹਨਾਂ ਦੀ ਉਨ੍ਹਾਂ ਨੂੰ ਉਨ੍ਹਾਂ ਦੀ ਖੁਸ਼ੀ ਪ੍ਰਗਟ ਕਰਦੇ ਆ ਆਪਣੀ ਦੇ ਕੇ ਅਤੇ ਇਸੇ ਤਰ੍ਹਾਂ ਮੈਂ ਵੀ ਆਪਣੀ ਬਰਡੇ 'ਤੇ ਆਪਣੇ ਰਿਸ਼ਤੇਦਾਰ ਅਤੇ ਗੁਆਂਢੀਆਂ ਨੂੰ ਬੁਲਾ ਕੇ ਸਾਰਿਆਂ ਲਈ ਭਿੰਨ ਭਿੰਨ ਪ੍ਰਕਾਰ ਦੇ ਖਾਣਾ ਤਿਆਰ ਕੀਤਾ ਸੀ ਅਤੇ ਸਾਰਿਆਂ ਨੇ ਖਾ ਜਦੋਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਦਾ ਅਤੇ ਸਾਰਿਆਂ ਨੂੰ ਅਲੱਗੇ ਹੀ ਖੁਸ਼ੀ ਅਤੇ ਆਨੰਦ ਮਹਿਸੂਸ ਹੋਇਆ